ਇੱਕੀ ਇੱਕ ਸੌ ਨੜਿੱਨਵੇਂ ਪੰਜ ਹਜ਼ਾਰ ਨੌਂ ਸੌ ਪੰਝੱਤਰ ਇੱਕੀ ਹਜ਼ਾਰ ਚਾਰ ਸੌ ਪੈਂਤੀ ਇੱਕ ਲੱਖ ਉਣੰਜਾ ਚਾਰ ਹਜ਼ਾਰ ਨੌਂ ਸੌ ਤੀਹ